ਸਤਿ ਸ਼੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਹਾਂਜੀ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਵਾਏਫਾਏ ਜਾਂ ਮੋਬਾਇਲ ਡਾਟਾ ਇਹ ਵਰਤਣਾ ਇੱਕ ਲਾਜ਼ਮੀ ਗੱਲ ਹੈ ਅਤੇ ਇਹ ਸਾਰੇ ਹੀ ਵਰਤਦੇ ਹੈ ਇਹਨਾਂ ਬਿਨਾਂ ਕਿਸੇ ਦਾ ਵੀ ਜਿਹੜਾ ਜੀਵਨ ਆ ਉਹ ਵੀ ਇੱਕ ਅਧੂਰਾ ਹੀ ਹੈ ਇਹ ਇੱਕ ਜੀਵਨ ਦਾ ਸਾਡਾ ਇੱਕ ਹਿੱਸਾ ਬਣ ਚੁੱਕਾ ਹੋਇਆ ਮੈਂ ਜਿਹੜਾ ਰੋਜ਼ ਦਾ ਮੇਰਾ ਡੇਰਾ ਉਹ ਹੈਗਾ ਵਾ ਡਾਟਾ ਉਹ ਹੈਗਾ ਡੇਢ ਜੀਬੀ ਦਾ ਉਹ ਵਰਤ ਲੈਂਦੀ ਹਾਂ ਅਤੇ ਜਿਹੜਾ ਇੱਕ ਨੈਟਵਰਕ ਦੀ ਸਮੱਸਿਆ ਹਾਂ ਅਗਰ ਅਸੀਂ ਕਿਸੇ ਬਾਹਰ ਮੈਂ ਜਾਂਦੀ ਕਿਸੇ ਆਪਣੇ ਇਲਾਕੇ ਤੋਂ ਆਪਣੇ ਖੇਤਰ ਤੋਂ ਬਾਹਰ ਜਾਂਦੀ ਕਿਸੇ ਬਾਹਰਲੇ ਸ਼ਹਿਰ ਵਗੈਰਾ ਕਿਤੇ ਜਾਂਦੀ ਹਾਂ ਉੱਥੇ ਕਈ ਵਾਰੀ ਮੈਨੂੰ ਮੈਨੂੰ ਮਤਲਬ ਕਿ ਕਰਨਾ ਪੈਂਦਾ ਵਾ ਇਨ ਇੱਦਾਂ ਨੈਟਵਰਕ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਨੈਟਵਰਕ ਜਾਂ ਸਲੋਅ ਹੁੰਦਾ ਜਾਂ ਘੱਟ ਹੁੰਦਾ ਵਾ ਅਤੇ ਮੈਂ ਸਾਹਮਣਾ ਉੱਥੇ ਵੀ ਕਈ ਵਾਰੀ ਕਰਨਾ ਪੈਂਦਾ ਵਾ ਬਾਕੀ ਮੋਬਾਇਲ ਜਾਂ ਨੈਟ ਮੋਬਾਇਲ ਡਾਟੇ ਬਿਨਾਂ ਜਾਂ ਨੈ ਵਾਏਫਾਏ ਦੇ ਵਾਏਫਾਏ ਦੇ ਬਿਨਾਂ ਜਿਹੜਾ ਮਤਲਬ ਕਿ ਫੋਨ ਆ ਉਹ ਸਾਡਾ ਕੁਛ ਵੀ ਨਹੀਂ ਕੰਮ ਕਰਦਾ ਅਤੇ ਸਾਨੂੰ ਮਤਲਬ ਕਿ ਵਰਤਣਾ ਹੀ ਪੈਂਦਾ ਵਾ ਮੋਬਾਇਲ ਡਾਟਾ ਮੋਬਾਇਲ ਡਾਟੇ ਦੇ ਨਾਲ ਜਿਹੜਾ ਸਾਰਾ ਅਸੀਂ ਮੋਬਾਇਲ ਫੋਨ ਦੇ ਵਿੱਚ ਹੋਏ ਅਤੇ ਮਤਲਬ ਕਿ ਹਰ ਇੱਕ ਚੀਜ਼ ਦੇਖ ਸਕਦੇ ਹਾਂ ਅਸੀਂ ਮਤਲਬ ਇੰਟਰਨੈਟ ਦੇ ਉੱਤੇ ਮਤਲਬ ਕਿ ਇੰਟਰਨੈਟ ਉੱਤੇ ਮਤਲਬ ਕਿ ਅਸੀਂ ਕੋਈ ਵੀ ਚੀਜ਼ ਦੇਖ ਸਕਦੇ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ ਫੋਨ 'ਤੇ ਅਸੀਂ ਕੁਝ ਵੀ ਅਸੀਂ ਦੇਖਣਾ ਜਾਂ ਕੁਛ ਕਈ ਵਾਰੀ ਕੋਈ ਕੰਮ ਹੁੰਦਾ ਸਾਨੂੰ ਉਹ ਵੀ ਆਪਾਂ ਕਰ ਸਕਦੇ ਹਾਂ ਮੋਬਾਇਲ ਡਾਟਾ ਜਾਂ ਵਾਏਫਾਏ ਤਾਂ ਜਿਹੜਾ ਵਾ ਅੱਜ ਕੱਲ੍ਹ ਦੇ ਜੀਵਨ ਦਾ ਵਿੱਚ ਇੱਕ ਸਾਡਾ ਹਿੱਸਾ ਹੀ ਬਣ ਚੁੱਕਾ ਆ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਹਨ ਬੱਚੇ ਬੱਚੇ ਤਾਂ ਬੱਚੇ ਤਾਂ ਵਾਏਫਾਏ ਜਾਂ ਨੈਟਵਰਕ ਫੇਰ ਜਿਹਦੇ 'ਚ ਹੋਏ ਉੱਥੇ ਵਿਚਾਰੇ ਬੈਠੇ ਰਹਿੰਦੇ ਹਨ ਗੇਮਾਂ ਖੇਲਦੇ ਰਹਿੰਦੇ ਆ ਵਾਏਫਾਏ ਦੇ ਉੱਤੇ ਕੁਛ ਚੀਜ਼ ਵੇਖਦੇ ਰਹਿੰਦੇ ਹਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸੋਸ਼ਲ ਮੀਡੀਆ ਅੱਜ ਕੱਲ੍ਹ ਦੇ ਜੀਵਨ ਦਾ ਇੱਕ ਬੜਾ ਪਾਰਟ ਬਣ ਗਿਆ ਹੈ ਸੋਸ਼ਲ ਮੀਡੀਆ ਦੀ ਜਿਹੜੀ ਵਰਤੋਂ ਜਿਹੜੀ ਹੁੰਦੀ ਹੈ ਉਹ ਮੋਬਾਇਲ ਡਾਟੇ ਬਗੈਰ ਨਹੀਂ ਹੋ ਸਕਦੀ ਮੋਬਾਇਲ ਡਾਟੇ ਬਿਨਾਂ ਜਿਹੜਾ ਫੋਨ ਆ ਉਹ ਅਸੀਂ ਨਹੀਂ ਕੁਛ ਵੀ ਵਰਤ ਸਕਦੇ ਮੋਬਾਇਲ ਡਾਟਾ 'ਤੇ ਵਰਤ ਹੋਣਾ ਵਿੱਚ ਲਾਜ਼ਮੀ ਹੈ ਅਤੇ ਅਸੀਂ ਜੋ ਵੀ ਕੋਈ ਹੈ ਸਾਡੇ ਐਪਸ ਸਾਡੇ ਆਪਾਂ ਵਰਤਦੇ ਹੈ ਫੋਨ ਵਿੱਚ ਕੁਛ ਸੋਸ਼ਲ ਮੀਡੀਆ ਦੇ ਉੱਤੇ ਬਸ ਵੇਖਣਾ ਵਾ ਇਸ ਦੇ ਲਈ ਮੋਬਾਇਲ ਡਾਟਾ ਦਾ ਹੋਣਾ ਬਹੁਤ ਜ਼ਰੂਰੀ ਹੈ